ਸਕੂਲ ਦੇ ਵਿੱਚ ਪੜ੍ਹਦੇ ਸਮੇਂ ਬਹੁਤ ਵਿਸ਼ਿਆਂ ਦੇ ਵਿੱਚ ਰੋਚਕ ਪੱਧਰ ਦੇ ਨਾਲ ਪੜ੍ਹਾਈ ਕੀਤੀ ਪਰ ਵਿਗਿਆਨ ਇੱਕ ਐਸਾ ਵਿਸ਼ਾ ਸੀ ਜਿਸਦੇ ਵਿੱਚ ਪੜ੍ਹਨ ਦਾ ਬਹੁਤ ਹੀ ਆਨੰਦ ਲਿਆ ਕਿਉਂਕਿ ਵਿਗਿਆਨ ਦੇ ਅੰਦਰ ਵੱਖੋ ਵੱਖਰੀਆਂ ਖੋਜਾਂ ਕਰਨ ਨੂੰ ਮਿਲਦੀਆਂ ਸੀ ਵੱਖੋ ਵੱਖਰੇ ਪੱਧਰ 'ਤੇ ਪ੍ਰੈਕਟੀਕਲ ਕਰਵਾਏ ਜਾਂਦੇ ਸਨ ਜਿਸ ਕਰਕੇ ਇਸ ਨੂੰ ਬੜੇ ਆਨੰਦ ਦੇ ਨਾਲ ਪੜ੍ਹਿਆ ਜਾਂਦਾ ਸੀ ਖੋਜ ਹੋਣ ਦੇ ਕਾਰਨ ਇੱਕ ਨਵੀਂ ਚੀਜ਼ ਵੇਖਣ ਨੂੰ ਸੁਣਨ ਨੂੰ ਜਾਂ ਪ੍ਰੈਕਟੀਕਲ ਕਰਨ ਨੂੰ ਮਿਲਦੀ ਸੀ